ਗੋਡਿਆਂ ਦੇ ਦਰਦ ਦੀ ਸਮੱਸਿਆ ਅੱਜ ਕੱਲ੍ਹ ਆਮ ਹੋ ਗਈ ਹੈ ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਖਾਣਾ ਪੀਣਾ ਸਹੀ ਨਹੀਂ ਹੈ ਲੋਕ ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਹਨ ਜੋ ਅੱਗੇ ਜਾ ਕੇ ਕਿਸੇ ਨਾ ਕਿਸੇ ਤਕਲੀਫ਼ ਦਾ ਕਾਰਨ ਬਣਦਾ ਹੈ ਉਨ੍ਹਾਂ ਚੋਂ ਇੱਕ ਗੋਡਿਆਂ ਦਾ ਦਰਦ ਵੀ ਹੈ ਲੋਕ ਔਰਥੋਪੈਡਿਕਸ ਦੀ ਦਵਾਈ ਖਾਣ ਦੀ ਥਾਂ ਘਰੇਲੂ ਇਲਾਜ ਵੀ ਕਰਦੇ ਹਨ ਜ਼ਿਆਦਾਤਰ ਲੋਕ ਘਰੇਲੂ ਹੀ ਇਲਾਜ ਕਰਦੇ ਹਨ ਜੋ ਕਿਤੇ ਨਾ ਕਿਤੇ ਫ਼ਰਕ ਵੀ ਪਾਉਂਦਾ ਹੈ ਮਤਲਬ ਠੀਕ ਵੀ ਕਰਦਾ ਹੈ ਗੋਡਿਆਂ ਦੇ ਦਰਦ ਨੂੰ ਮੇਰੇ ਇਲਾਕੇ ਵਿੱਚ ਕੁੱਝ ਇਲਾਜ ਕੀਤੇ ਜਾਂਦੇ ਹਨ ਜਿਵੇਂ ਕਿ ਕਈ ਕੀ ਕਰਦੇ ਹਨ ਅੱਕ ਦਾ ਬੂਟਾ ਜੋ ਹੁੰਦਾ ਹੈ ਉਸਦੀਆਂ ਜੜ੍ਹਾਂ ਨੂੰ ਤੇਲ ਵਿੱਚ ਉਬਾਲ ਕੇ ਗੋਡਿਆਂ ਉੱਤੇ ਲਗਾਉਂਦੇ ਹਨ ਅਤੇ ਥੋੜ੍ਹੀ ਥੋੜ੍ਹੀ ਮਾਲਿਸ਼ ਕਰਦੇ ਹਨ ਅਤੇ ਹੋਰ ਜਾਂ ਰਾਤ ਦੀ ਬਾਸੀ ਰੋਟੀ ਜੋ ਹੁੰਦੀ ਹੈ ਉਸ 'ਤੇ ਘਿਓ ਲਾ ਕੇ ਗੋਡਿਆਂ ਨਾਲ ਬੰਨ੍ਹ ਲੈਂਦੇ ਹਨ ਜੋ ਬਹੁਤ ਆਰਾਮ ਪਹੁੰਚਾਉਂਦਾ ਹੈ ਅਤੇ ਆਮ ਤੌਰ 'ਤੇ ਲੋਕ ਬਾਜ਼ਾਰ ਵਿੱਚ ਮਿਲਣ ਵਾਲੀਆਂ ਦਵਾਈਆਂ ਜਾਂ ਸਮਾਨ ਜਿਵੇਂ ਮੂਵ ਸਪ੍ਰੇਅ ਆਇਓਡੈਕਸ ਜੰਡੂ ਬਾਮ ਵਗੈਰਾ ਦਾ ਵੀ ਇਸਤੇਮਾਲ ਕਰਦੇ ਹਨ